ਸ਼ੋਸ਼ਲ ਮੀਡੀਆ ਦੇ ਕੁਛ ਖਾਤੇ ਫੋਟੋਗ੍ਰਾਫਸ ਜਿਵੇਂ ਕਿ ਬਰਡਸ ਨੇਚਰ ਨੇਚਰ ਲਵਰ ਬਿਊਟੀਫੁੱਲ ਨੇਚਰ ਪਲਾਂਟ ਆਫ ਫਾਈਨਰੀ ਨੇਚਰ ਐਂਡ ਏ ਦ ਲਿਟਲ ਜੰਗਲ ਰੂਮ ਇਹ ਫੋਟੋਗ੍ਰਾਫਸ ਮੈਨੂੰ ਬਹੁਤ ਵਧੀਆ ਲੱਗਦੇ ਹਨ ਮੈਂ ਇਸ ਦੀ ਪਾਲਣਾ ਕਰਦੀ ਹਾਂ